ਹੈਲੋ ਸਤਿ ਸ਼੍ਰੀ ਅਕਾਲ ਭਾਜੀ ਆਪਾਂ ਕਿੱਥੇ ਕੁ ਤੱਕ ਪਹੁੰਚ ਗਏ ਹਾਂ ਮੈਨੂੰ ਲੱਗਦਾ ਅੰਬਾਲਾ ਯ ਅੰਬਾਲੇ ਤੱਕ ਆਏ ਹਾਂ ਕਿਉਂਕਿ ਮੇਰੀ ਫਲਾਈਟ ਵੀ ਹੈਗੀ ਹੈ ਮੌਰਨਿੰਗ ਸਵੇਰੇ ਚਾਰ ਵਜੇ ਕਨੇਡਾ ਦੀ ਅਤੇ ਹੜ੍ਹਾਂ ਕਰਕੇ ਰਸਤੇ ਵੀ ਕਾਫ਼ੀ ਖਰਾਬ ਹੋ ਚੁੱਕੇ ਨੇ ਆਪਾਂ ਹੁਣ ਜਿਸ ਰਸਤੇ ਤੋਂ ਜਾ ਰਹੇ ਹਾਂ ਇਹ ਠੀਕ ਵੀ ਹੈਗਾ ਅੱਗੇ ਕਿਉਂਕਿ ਹਂ ਹੜ੍ਹਾਂ ਕਰਕੇ ਵੀ ਮੀਂਹਾਂ ਕਰਕੇ ਰਸਤੇ ਦਾ ਕਾਫ਼ੀ ਓਹ ਹੋ ਗਿਆ ਹੈਗਾ ਤਾਂ ਦਿੱਲੀ ਮੈਨੂੰ ਚਾਰ ਵਜੇ ਤੱਕ ਪਹੁੰਚਣਾ ਏ ਆਂ ਅਤੇ ਉੱਥੇ ਮੇਰੀ ਕਾਫ਼ੀ ਸਾਰੇ ਰਿਸ਼ਤੇਦਾਰ ਮੇਰੀ ਵੇਟ ਕਰ ਰਹੇ ਨੇ ਤੁਸੀਂ ਇੱਕ ਵਾਰੀ ਕਿਸੇ ਤੋਂ ਕਨਫਰਮ ਕਰ ਲਓ ਵੀ ਰਸਤਾ ਠੀਕ ਆ ਆਪਾਂ ਨੂੰ ਕਿਤੇ ਟਾਈਮ ਵੇਸਟ ਨਾ ਹੋਵੇ ਉੱਥੇ ਫਿਰ ਮੁੜ ਕੇ ਆਈਏ ਤਾਂ ਇੱਕ ਵਾਰੀ ਪਤਾ ਕਰ ਲਓ ਫਿਰ ਸਹੀ ਰਹੇਗਾ ਬਾਕੀ ਥੈਂਕ ਯੂ ਭਾਜੀ